ਸਾਡੇ ਸਥਾਨਾਨਾਂ ਖੇਤਰ ਰਾਜਾ ਵਿੱਚ ਕਈ ਤਰ੍ਹਾਂ ਦੇ ਖੇਡਡ ਸਮਾਗਮ ਟੂਰਨਾਮੈਂਟ ਕਰਵਾਏ ਜਾਂਦੇ ਹਨ ਜੋ ਕਿ ਇਹ ਟੂਰਨਾਮੈਂਟ ਵਿੱਚ ਹਰ ਕਈ ਤਰ੍ਹਾਂ ਦੇ ਬੱਚੇ ਟੂਰਨਾ ਵਿੱਚ ਭਾਗ ਲੈਂਦੇ ਹਨ ਸਾਡੇ ਪਿੰਡ ਵਿੱਚ ਤਿੰਨ ਮਹੀਨਿਆਂ ਬਾਅਦ ਹੀ ਇਕ ਨਾ ਇਕ ਟੂਰਨਾਮੈਂਟ ਕਰਾਇਆ ਜਾਂਦਾ ਹੈ ਜਿਵੇਂ ਕਿ ਫੁੱਟਬੌਲ ਅਤੇ ਕ੍ਰਿਕਟ ਇਹ ਟੂਰਨਾਮੈਂਟ ਕਰਵਾਏ ਜਾਂਦੇ ਹਨ ਜੇ ਇਹ ਟੂਰਨਾ ਵਿੱਚ ਵਿੱਚ ਵਿੱਚ ਬ ਕਈ ਪਿੰਡਾਂ ਦੇ ਜਵਾਕ ਖੇਡਣ ਲਈ ਆਉਂਦੇ ਹਨ ਜਿਹੜੇ ਜਿੱਤ ਜਾਂਦੇ ਹਨ ਉਹਨਾਂ ਨੂੰ ਸ ਇਹ ਪਿੰਡ ਦੀ ਪੰਚਾਇਤ ਵੱਲੋਂ ਇਨਾਮ ਵੀ ਦਿੱਤੇ ਜਾਂਦੇ ਹਨ ਅਤੇ ਉਹਨਾਂ ਦੀ ਅੰਤਰਰਾਸ਼ਟਰੀ ਪੱਧਰ ਬ ਅਤੇ ਹੋਰ ਵੀ ਉੱਚੇ ਪੱਧਰ 'ਤੇ ਨ ਹੋਰ ਜ਼ਿਆਦਾ ਟੂਰਨਾਮੈਂਟਰ ਕਰਵਾਏ ਜਾਂਦੇ ਹਨ ਅਤੇ ਇਹ ਟੂਰਨਾਮੈਂਟ ਵਿੱਚ ਫਿਰ ਹੋਰ ਵੀ ਜ਼ਿਆਦਾ ਵੱਡੇ ਪੱਧਰ 'ਤੇ ਜਾ ਕੇ ਖੇਡ ਬੱਚੇ ਖੇਡਦੇ ਹਨ ਜੋ ਜਿੱਤ ਅ ਜਿੱਤ ਜਾਂਦੇ ਹਨ ਅਤੇ ਇਹ ਟੂਰਨਾਮੈਂ

ਪਿੰਡ ਦੇ ਏ ਪੰਚਾਇਤ ਵੱਲੋਂ ਹੀ ਕਰਵਾਏ ਜਾਂਦੇ ਹਨ ਅਤੇ ਬੱਚਿਆਂ ਬੱਚੇ ਹਰ ਇੱਕ ਬੱਚੇ ਇਸ ਵਿੱਚ ਭਾਗ ਲੈ ਸਕਦੇ ਹਨ ਅਤੇ ਇਹ ਟੂਰਨਾਮੈਂਟ ਵਿੱਚ ਜੋ ਵੀ ਬੱਚੇ ਭਾਗ ਲੈਂਦੇ ਹਨ ਅਤੇ ਉਹ ਜੇਤੂ ਹੁੰਦੇ ਹਨ ਅਤੇ ਉਹਨਾਂ ਨੂੰ ਅੱਗੇ ਭੇਜਿਆ ਜਾਂਦਾ ਅਤੇ ਉਹ ਅੱਗੋਂ ਵੀ ਹੋਰ ਵੀ ਜ਼ਿਆਦਾ ਆਪਦਾ ਆਪਣਾ ਅਤੇ ਇਹ ਪਿੰਡ ਦਾ ਅਤੇ ਮਾਂ ਪਿਓ ਦਾ ਨਾਮ ਰੌਸ਼ਨ ਕਰਦੇ ਹਨ